ਦਿਵਾਲੀ ਲਗਭਗ ਆਪਣੇ ਅਕਤੂਬਰ ਜਾਂ ਨਵੰਬਰ ਮੰਥ ਵਿੱਚ ਪੰਜਾਬ ਵਿੱਚ ਮਨਾਈ ਜਾਂਦੀ ਪੰਜਾਬ ਕੀ ਆਪਣੇ ਪੂਰੇ ਇੰਡੀਆ ਵਿੱਚ ਮਨਾਈ ਜਾਂਦੀ ਹੈ ਇੰਡੀਆ ਵਿੱਚ ਵੀ ਕੀ ਅੱਜ ਕੱਲ੍ਹ ਤਾਂ ਇੰਟਰਨੈਸ਼ਨਲ ਫੈਸਟੀਵਲ ਹੋ ਗਿਆ ਇਹ ਦਿਵਾਲੀ ਦਾ ਅਤੇ ਦਿਵਾਲੀ ਵੈਸੇ ਜੋ ਹਿੰਦੂ ਭਾਈਚਾਰਾ ਮਨਾਉਂਦਾ ਉਹ ਆਪਣੇ ਜਿਵੇਂ ਸਭ ਜਾਣਦੇ ਆ ਕਿ ਸ਼੍ਰੀ ਰਾਮ ਚੰਦਰ ਜੀ ਬਨਵਾਸ ਕੱਟ ਕੇ ਜਦੋਂ ਅਯੋਧਿਆ ਵਾਪਿਸ ਆਏ ਸੀ ਉਸ ਦੀ ਖੁਸ਼ੀ ਵਿੱਚ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਜੋ ਦੀਪਮਾਲਾ ਕੀਤੀ ਗਈ ਅਤੇ ਉਹ ਹੌਲੀ ਹੌਲੀ ਰੂਪ ਦੀਪਮਾਲਾ ਦੇ ਨਾਲ ਨਾਲ ਅੱਜ ਕੱਲ੍ਹ ਲੋਕ ਪਟਾਕੇ ਵੀ ਫੋੜਦੇ ਨੇ ਹੈ ਨਾ ਪਰ ਜੋ ਸਿੱਖ ਭਾਈਚਾਰਾ ਦਿਵਾਲੀ ਨੂੰ ਆਪਣੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਉਹਨਾਂ ਨੇ ਉਸ ਦਿਨ ਮਤਲਬ ਬਵੰਜਾ ਰਾਜਿਆਂ ਨੂੰ ਹੋਰ ਵੀ ਰਿਹਾਅ ਕਰਵਾਇਆ ਸੀ ਆਪਣੇ ਆਪ ਦੇ ਨਾਲ ਨਾਲ ਤਾਂ ਸਿੱਖ ਭਾਈਚਾਰਾ ਉਸ ਚੀਜ਼ ਦੀ ਖੁਸ਼ੀ ਵਿੱਚ ਘਰ ਵਿੱਚ ਦੀਪਮਾਲਾ ਕਰਦਾ ਹੈ ਰੌਸ਼ਨੀਆਂ ਦਾ ਰੋਸ਼ਨੀਆਂ ਦਾ ਤਿਉਹਾਰ ਹੈ ਇਹ ਅਤੇ ਮਤਲਬ ਦਿਵਾਲੀ ਵਾਲੇ ਦਿਨ ਲੋਕ ਆਪਸ ਦੇ ਵਿੱਚ ਬੜੇ ਮਿਲਦੇ ਨੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਮਿਠਾਈਆਂ ਵੀ ਵੰਡਦੇ ਨੇ ਇੱਕ ਦੂਜੇ ਨੂੰ ਮਿਠਾਈਆਂ ਵੀ ਖਵਾਉਂਦੇ ਨੇ ਅਤੇ ਨਵੇਂ ਕੱਪੜੇ ਵੀ ਮਤਲਬ ਪਾਉਂਦੇ ਨੇ ਇੱਕ ਦੂਜੇ ਨੂੰ ਗਿਫਟ ਦੇਣ ਦਾ ਵੀ ਜੋ ਕੀ ਹੈ ਰਿਵਾਜ਼ ਹੈ ਤਾਂ ਇਸ ਦਿਨ ਬਾਕੀ ਸਭ ਨੇ ਤਾਂ ਖੁਸ਼ ਹੋਣਾ ਹੀ ਹੋਣਾ ਜੋ ਬੱਚੇ ਹੁੰਦੇ ਆ ਉਸ ਦਿਨ ਬੜਾ ਖੁਸ਼ ਹੁੰਦਾ ਕਿਉਂਕਿ ਉਹ ਪਟਾਕੇ ਵਗੈਰਾ ਚਲਾਉਂਦੇ ਆ ਹੈ ਨਾ ਤਾਂ ਰਹੀ ਗੱਲ ਦੂਸਰੀ ਆਪਣੀ ਹੋਲੀ ਦੀ ਹੋਲੀ ਲਗਭਗ ਮਾਰਚ ਮਹੀਨੇ ਦੇ ਵਿੱਚ ਹੀ ਆਉਂਦੀ ਹੈ ਤਾਂ ਉਸ ਦਿਨ ਵੀ ਲੋਕ ਬੜੇ ਉਤਸ਼ਾਹ ਨਾਲ ਬੜੀ ਖੁਸ਼ੀ ਨਾਲ ਆਪਸ ਦੇ ਵਿੱਚ ਮਿਲ ਕੇ ਇਹ ਰੰਗਾਂ ਦਾ ਤਿਉਹਾਰ ਜੋ ਕਿ ਮਨਾਉਂਦੇ ਆ ਲੋਕ ਆਂਢ ਗੁਆਂਢ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਜਾ ਕੇ ਇਸ ਚੀਜ਼ ਨੂੰ ਹੋਲੀ ਜੋ ਤਿਉਹਾਰ ਆ ਉਸਨੂੰ ਸੈਲੀਬਰੇਟ ਕਰਦੇ ਇਹ ਤਿਉਹਾਰ ਵੀ ਜੋ ਪੰਜਾਬੀ ਭਾਈਚਾਰੇ ਨੂੰ ਛੱਡ ਕੇ ਜੋ ਬਾਕੀ ਭਾਈਚਾਰਾ ਲਾਈਕ ਅਦਰ ਸਟੇਟਸ ਹੈ ਜਿਵੇਂ ਕਿ ਆਪਣੇ ਇੰਡੀਆ ਆਪਣੇ ਰਾਜਸਥਾਨ ਹਰਿਆਣਾ ਉੜੀਸਾ ਯੂ ਪੀ ਸਭ ਜਿਹੜਾ ਸਟੇਟਾਂ ਦੇ ਵਿੱਚ ਇਹ ਮਨਾਈ ਜਾਂਦੀ ਹੋਲੀ ਤਾਂ ਉਸ ਤੋਂ ਬਾਅਦ ਹੋਲੀ ਤੋਂ ਬਾਅਦ ਜਿਵੇਂ ਹੋਰ ਵੀ ਤਿਉਹਾਰ ਆ ਜਾਂਦੇ ਜਿਵੇਂ ਲੋਹੜੀ ਲੋਹੜੀ ਹੋ ਗਈ ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਮਨਾਈ ਜਾਂਦੀ ਹੈ ਅਤੇ ਇਸ ਦਿਨ ਜਿਸ ਘਰ ਬੱਚਾ ਹੋਇਆ ਹੁੰਦਾ ਨਿ ਕੁੜੀ ਹੋਵੇ ਮੁੰਡਾ ਹੋਇਆ ਅੱਜ ਕੱਲ੍ਹ ਕੋਈ ਫਰਕ ਨਹੀਂ ਉਸ ਚੀਜ਼ ਦਾ ਤਾਂ ਉਹ ਬੜੇ ਤਰੀਕੇ ਨਾਲ ਬੜੇ ਸਲੀਕੇ ਨਾਲ ਆਪਣੇ ਬੱਚੇ ਦੀ ਲੋਹੜੀ ਵੰਡਦੇ ਆ ਅਤੇ ਬੜੀਆਂ ਖੁਸ਼ੀਆਂ ਦੇ ਢੋਲ ਨਗਾਰੇ ਬਜਾਏ ਜਾਂਦੇ ਆ ਬੜੀ ਖੁਸ਼ੀ ਮਨਾਉਂਦੇ ਆ ਪਰ ਹੁਣ ਜੇ ਦੇਖਿਆ ਜਾਵੇ ਤਾਂ ਉਹ ਤਿਉਹਾਰ ਅਜਿਹੇ ਤਿਉਹਾਰ ਨਾ ਰਹਿ ਕੇ ਬਸ ਸਿਰਫ਼ ਇਕ ਦਿਨ ਮਨਾਇਆ ਜਾਂਦਾ ਕਿ ਕਿਉਂਕਿ ਉਹ ਲੋਕਾਂ 'ਚ ਉਤਸ਼ਾਹ ਵਗੈਰਾ ਅੱਜ ਕੱਲ੍ਹ ਨਹੀਂ ਦੇਖਣ ਨੂੰ ਮਿਲਦਾ ਹੈ ਨਾ ਬਾਕੀ ਜੋ ਤਿਉਹਾਰ ਆ ਉਹ ਤਿਉਹਾਰ ਤਾਂ ਹੈ ਹੀ ਧੰਨਵਾਦ ਜੀ